ਹੈਲੋ ਹਾਂਜੀ ਮੈਂ ਸੁਖਵੰਤ ਸਿੰਘ ਬੋਲਦਾ ਜੀ ਇੱਕ ਤਾਂ ਜੀ ਤੁਹਾਨੂੰ ਪਹਿਲਾਂ ਤਾਂ ਉਲਾਂਭਾ ਹੈ ਵੀ ਥੋਤੋਂ ਇੱਕ ਸੋਫਾ ਮੰਗਵਾਇਆ ਸੀ ਪਹਿਲਾਂ ਤਾਂ ਉਹ ਪਹੁੰਚਿਆ ਹੀ ਪੰਦਰਾਂ ਦਿਨ ਬਾਅਦ ਹੈ ਜਿੱਦਣ ਦਾ ਤੁਸੀਂ ਸਾਡੇ ਨਾਲ ਵਾਅਦਾ ਕਰਿਆ ਸੀ ਪੰਦਰਾਂ ਦਿਨ ਤੁਸੀਂ ਵੈਸੇ ਹੀ ਲੰਘਾ ਤੇ ਫੇਰ ਜਿਹੜਾ ਭੇਜਿਆ ਤੁਸੀਂ ਸਾਨੂੰ ਫਰੀ ਡਿਲੀਵਰੀ ਕਿਹਾ ਸੀ ਵੀ ਘਰ ਫਰੀ ਬਿਨਾ ਕਿਰਾਏ ਤੋਂ ਭੇਜਾਂਗੇ ਉਹ ਤੁਹਾਡਾ ਜਿਹੜਾ ਟੈਂਪੂ ਵਾਲਾ ਕਿਰਾਇਆ ਲੈਣ ਕਹਿੰਦਾ ਮੈਨੂੰ ਪੰਜ ਸੌ ਰੁਪਈਆ ਦਿਉ ਜਮਾ ਨਿਕੰਮਾ ਬੰਦਾ ਭੇਜਤਾ ਜੀ ਤੁਸੀਂ ਨਾ ਉਹ ਤਾਂ ਸਾਡੇ ਨਾਲ ਲਹਾਇਆ ਵੀ ਨਹੀਂ ਜੀ ਉਹਨੇ ਚਲੋ ਕਰ ਕਰਾ ਕੇ ਲਾਹਿਆ ਸ਼ਾਮ ਨੂੰ ਅਸੀਂ ਸਾਰਾ ਟੱਬਰ ਜਦੋਂ ਉਹ 'ਤੇ ਟੀ ਵੀ ਮਾਲਕ ਜਵਾਕ ਸਾਡਾ ਬੈਠੇ ਉਹ ਯਾਰ ਐਨਾ ਨਿਕੰਮਾ ਉਹਨੂੰ ਘੁਣਾ ਲੱਗਿਆ ਹੋਇਆ ਪਹਿਲਾਂ ਤਾਂ ਗੱਲ ਤੁਸੀਂ ਗੱਲ ਸੁਣ ਲਉ ਤੁਸੀਂ ਪਟੀਨ ਭਰ ਭਰ ਕੇ ਵੇਚੀ ਜਾਂਦੇ ਹੋ ਸਾਰਾ ਤਾਂ ਉਹਨੂੰ ਘੁਣਾ ਲੱਗਿਆ ਹੋਇਆ ਕੱਪੜਾ ਉਹਦਾ ਜਮਾ ਹੀ ਰੱਦੀ ਜਿਹੜਾ ਰੰਗ ਮੈਂ ਪਸੰਦ ਕਰੇ ਤੇ ਉਹ ਰੰਗੇ ਹੈ ਨਹੀਂ ਨਹੀਂ ਵੀ ਇਹ ਗੱਲ ਠੀਕ ਨਹੀਂ ਗੀ ਤੁਸੀਂ ਐਂ ਕਰੋ ਇਹ ਜਿਹੜਾ ਸਾਡਾ ਸੋਫਾ ਜਾਂ ਤਾਂ ਸਾਨੂੰ ਸੋਫਾ ਬਦਲ ਕੇ ਸਾਡਾ ਜਿਹੜਾ ਪਸੰਦ ਕੀਤਾ ਸੀ ਉਹ ਸੋਫਾ ਸਾਡਾ ਦਿਉ ਨਹੀਂ ਸਾਡੇ ਪੈਸੇ ਦਿਉ ਹਾਂ ਪੈਸੇ ਸਾਡੇ ਵਾਪਸ ਕਰੋ ਨਹੀਂ ਠੀਕ ਹੈ ਜੀ ਧੰਨਵਾਦ